ਆਪਣੇ ਬਾਗ ਵਿੱਚ ਉੱਗੇ ਹੋਏ ਫੁੱਲਾਂ ਅਤੇ ਫਲਾਂ ਨੂੰ ਅਸੀਂ ਆਪਣੀ ਬੱਚਿਆਂ ਵਾਂਗੂ ਪਾਲਦੇ ਹਾਂ ਇਸ ਲਈ ਇਹਨਾਂ ਦੀ ਸਿਹਤ ਸੰਭਾਲ ਅਤੇ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਵੀ ਜਿੰਮੇਵਾਰੀ ਸਾਡੀ ਹੀ ਹੁੰਦੀ ਹੈ ਜਿਵੇਂ ਕਿ ਸਾਡੇ ਬਾ ਬਾਗ ਵਿੱਚ ਅੱਜ ਕੱਲ੍ਹ ਅਨਾਰ ਅੰਬ ਅਮਰੂਦ

ਜਾਮਣ ਅਤੇ ਹੋਰ ਫਲਦਾਰ ਪੌਦੇ ਉ ਉੱਗਦੇ ਹਨ ਅਸੀਂ ਉਹਨਾਂ ਪੌਦਿਆਂ ਦੀ ਦੇਖਭਾਲ ਦੇ ਨਾਲ ਨਾਲ ਫਲਾਂ ਨੂੰ ਵੀ ਬਹੁਤ ਸਹੀ ਤਰੀਕੇ ਨਾਲ ਤਿਆਰ ਕਰਕੇ ਉਹਨਾਂ ਨੂੰ ਉਹਨਾਂ ਦੀ ਸੇ ਸੰਭਾਲ ਦੇ ਜਿੰਮੇਵਾਰੀ ਵੀ ਸਾਡੀ ਹੀ ਹੁੰਦੀ ਹੈ ਇਸ ਵਾਸਤੇ ਅਸੀਂ ਆਪਣੇ ਫਲਾਂ ਨੂੰ ਜਾਂ ਤਾਂ ਨਜ਼ਦੀਕੀ ਮੰਡੀਆਂ ਵਿੱਚ ਜਾ ਕੇ ਵੇਚਦੇ ਦਿੰਦੇ ਹਾਂ ਅਗਰ ਜਾਂ ਅਗਰ ਬਹੁਤ ਜ਼ਿਆਦਾ ਕਾਸ਼ਤ ਹੁੰਦੀ ਹੈ ਜਿਵੇਂ ਕਿ ਕਿਨੂੰਆਂ ਦੀ ਅਮਰੂਦ ਆਦਿ ਫਲ ਜਾਂ ਉਹਨਾਂ ਨੂੰ ਅਸੀਂ ਨੇੜੇ ਦੀਆਂ ਮੰਡੀਆਂ ਵਿੱਚ ਜਾ ਕੇ ਵੇਚ ਦਿੰਦੇ ਹਾਂ ਥੋੜ੍ਹੀ ਮਾਤਰਾ ਵਿੱਚ ਉੱਗਣ ਵਾਲੇ ਫਲਾਂ ਨੂੰ ਅਸੀਂ ਘਰ ਵਿੱਚ ਹੀ ਖੁਦ ਹੀ ਵਰਤ ਲੈਂਦੇ ਹਾਂ ਅਤੇ ਜਾਂ ਆਪਣੇ ਰਿਸ਼ਤੇਦਾਰਾਂ ਨਜ਼ਦੀਕੀ ਪੜੋਸੀਆਂ ਨੂੰ ਵੀ ਗੁਆਂਢੀਆਂ ਨੂੰ ਵੀ ਉਹ ਖਾਣ ਵਾਸਤੇ ਦਿੰਦੇ ਹਾਂ ਉਸੇ ਤਰ੍ਹਾਂ ਫਲਾਂ ਫਲਾਂ ਦੀ ਤਰ੍ਹਾਂ ਫੁੱਲਾਂ ਦੀ ਖੇਤੀ ਕਰਦੇ ਹੋਏ ਅਗਰ ਅਸੀਂ ਫੁੱਲਾਂ ਦੀ ਵੀ ਦੇਖ ਭਾਲ ਅ ਬੜੇ ਸਹਿਜ ਤਰੀਕੇ ਨਾਲ ਕਰਦੇ ਹਾਂ ਫੁੱਲਾਂ ਨੂੰ ਅਸੀਂ ਤੁੜਾਈ ਕਰਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਭੇਜਦੇ ਹਾਂ